ਸਿੱਖ ਧਰਮ ਦੀਆਂ ਸਿੱਖਿਆਵਾਂ ਸਥਾਨਿਕ ਸੱਭਿਆਚਾਰ ਨੂੰ ਲੈ ਕੇ ਬਹੁਤ ਸਾਰਾ ਭਾਈਚਾਰਾ ਦਰਸਾਉਂਦੀਆਂ ਹਨ ਜਿਵੇਂ ਕਿ ਸਮਾਜਿਕ ਅਤੇ ਨੈਤਿਕ ਦੇ ਮੁੱਦਿਆਂ 'ਤੇ ਵੀ ਇਸ ਦਾ ਪ੍ਰਭਾਵ ਪੈਂਦਾ ਹੈ ਜਿਵੇਂ ਕਿ ਸਮਾਜਿਕ ਮੁੱਦਿਆਂ 'ਤੇ ਆਈਏ ਤਾਂ ਔਰਤ ਨੂੰ ਹਰ ਕੋਈ ਆਪਣੇ ਪੈਰਾਂ ਦੀ ਜੁੱਤੀ ਸਮਝਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਸਲੋਕ ਜਿਹੜਾ ਉਚਾਰਿਆ ਹੈ ਕਿ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਕਿ ਜਿਹੜੀ ਇਹ ਮਾਂ ਐਂ ਤੁਸੀਂ ਇਹਨੂੰ ਫਟਕਾਰਦੇ ਕਿਉਂ ਹੋ ਇਹ ਤਾਂ ਵੱਡੇ ਵੱਡੇ ਰਾਜਿਆਂ ਨੂੰ ਜਿਹੜਾ ਜਨਮ ਦੇਣ ਵਾਲੀ ਹੈ ਸੋ ਅਤੇ ਇਸ ਨੈਤਿਕ ਮੁੱਦਿਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਜਿਹੜਾ ਭਾਈਚਾਰੇ ਦੀ ਪ੍ਰਭਾਵਿਤ ਕਰਦਾ ਹੈ ਜਿਵੇਂ ਕਿ ਕਬੀਰ ਸਾਹਿਬ ਦਾ ਇੱਕ ਸਲੋਕ ਆਉਂਦਾ ਹੈ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ਕਿ ਅਵਲਿ ਅਲਹ ਜੇ ਅਲਹ ਰਾਮ ਰਹੀਮ ਇਹ ਸਭ ਜਿਹੜੇ ਹੈਗੇ ਨੇ ਸਾਰੇ ਧਰਮਾਂ ਦੇ ਜਿਹੜੇ ਇੱਥੋਂ ਸਭ ਭਾਈਚਾਰਾ ਦਰਸਾਉਂਦਾ ਹੈ ਕਿ ਅਸੀਂ ਸਾਰਿਆਂ ਨੇ ਇੱਕ ਦੂਜੇ ਨੂੰ ਰਿਸਪੈੱਕਟ ਦੇਣੀ ਹੈ ਇੱਕ ਦੂਜੇ ਦੀ ਕਦਰ ਕਰਨੀ ਹੈ ਅਤੇ ਪ੍ਰੇਮ ਦੀ ਭਾਸ਼ਾ ਬੋਲਦੇ ਹਨ ਅਤੇ ਸਭ ਇੱਕੋ ਹੀ ਹੈ ਉਸ ਇੱਕ ਤੋਂ ਹੀ ਇੱਕ ਦੇ ਹੀ ਬੰਦੇ ਹਨ ਉਸ ਇੱਕ ਤੋਂ ਹੀ ਉਤਪੇ ਹਨ ਅਤੇ ਸਭ ਸ ਧਰਮਾਂ ਨੂੰ ਇੱਕ ਬਰਾਬਰ ਮਹਾਨਤਾ ਦਿੱਤੀ ਹੈ ਅਤੇ ਸਾਨੂੰ ਆਪਸ ਵਿੱਚ ਪ੍ਰੇਮ ਬਣਾਉਣ ਅਤੇ ਰੱਖਣ ਦੇ ਲਈ ਵੀ ਇੱਕ ਵੱਡਾ ਸੁਨੇਹਾ ਦਿੱਤਾ ਜਾਂਦਾ ਹੈ